ਮੇਰਾ ਘਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਅਤੇ ਮੈਂ ਇੱਥੋਂ ਦੇ ਚਾਟੀਵਿੰਡ ਪਿੰਡ ਦੀ ਨਹਿਰ ਦੇ ਕੋਲ ਰਹਿੰਦਾ ਹਾਂ ਇਥੋਂ ਦੀ ਦੇਖਭਾਲ ਇੱਕ ਕਾਰ ਸੇਵਾ ਵਾਲੇ ਕਰਦੇ ਹਨ ਜਿਨ੍ਹਾਂ ਦਾ ਨਾਮ ਹੈ ਭੂਰੀ ਵਾਲੇ ਸੰਤ ਭੂਰੀ ਵਾਲੇ ਇਸ ਨਦੀ ਦੀ ਚੰਗੀ ਦੇਖਭਾਲ ਕਰਦੇ ਹਨ ਅਤੇ ਇਸ ਨੂੰ ਸਾਫ਼ ਅਤੇ ਸਾਂਭ ਸੰਭਾਲ ਲਗਾਤਾਰ ਚਲਦੀ ਰਹਿੰਦੀ ਹੈ ਇਸ ਵਿੱਚ ਅਸੀਂ ਵੋਟਿੰਗ ਵੀ ਕਰ ਸਕਦੇ ਹਾਂ ਅਤੇ ਪਾਣੀ ਸਾਫ਼ ਹੁੰਦਾ ਹੈ ਜਿਸ ਕਾਰਨ ਇਸ ਵਿੱਚ ਮਛਲੀਆਂ ਵੀ ਆਉਂਦੀਆਂ ਰਹਿੰਦੀਆਂ ਹਨ